ਹਾਂਜੀ ਲੋਕਡਾਊਨ ਦੇ ਵਿੱਚ ਲੋਕਾਂ ਨੇ ਮੋਬਾਇਲ ਅਤੇ ਲੈਪਟਾਪ ਦੀ ਜ਼ਿਆਦਾ ਵਰਤੋਂ ਕੀਤੀ ਹੈ ਕੀਤੀ ਕਿਉਂਕਿ ਉਸ ਟਾਈਮ ਸਾਰੀ ਸਟੱਡੀ ਜਿਹੜੀ ਸਕੂਲਿੰਗ ਸੀ ਉਹ ਵੀ ਔਨਲਾਈਨ ਸੀ ਕੰਮ ਵੀ ਦਫਤਰੀ ਕੰਮ ਵੀ ਕਰਨੇ ਸਾਰੇ ਲੈਪਟਾਪ 'ਤੇ ਔਨਲਾਈਨ ਹੀ ਕੀਤੇ ਜਾਂਦੇ ਸਨ ਸਭ ਨੇ ਵਰਤੋਂ ਬਹੁਤ ਕੀਤੀ ਹੈ ਮੈਂ ਵੀ ਕੀਤੀ ਸੀ ਮੈਂ ਪੜ੍ਹਾਇਆ ਸੀ ਔਨਲਾਈਨ ਅਤੇ ਇੰਨਾਂ ਮਜ਼ਾ ਨਹੀਂ ਆਇਆ ਸੀ ਪੜ੍ਹਾਉਣ ਦਾ ਬੱਚਿਆਂ ਨੂੰ ਕਈ ਵਾਰੀ ਆਵਾਜ਼ ਟੁੱਟ ਟੁੱਟ ਕੇ ਜਾਂਦੀ ਸੀ ਵਿੱਚੋਂ ਵਿੱਚੋਂ ਕੱਟ ਕੱਟ ਕੇ ਜਾਂਦੀ ਸੀ ਅਤੇ ਜੋ ਸਾਹਮਣੇ ਬੈਠ ਕੇ ਪੜ੍ਹਾਉਣ 'ਚ ਮਜ਼ਾ ਆਉਂਦਾ ਸੀ ਉਹ ਨਹੀਂ ਆਉਂਦਾ ਸੀ ਇੰਨਾਂ ਚੰਗਾ ਵੀ ਨਹੀਂ ਲੱਗਦਾ ਸੀ ਸਾਰਾ ਦਿਨ ਫੋਨ 'ਤੇ ਚਿਪਕ ਕੇ ਬਹਿਣਾ ਪੈਂਦਾ ਸੀ ਅਤੇ ਮੋਬਾਈਲ ਦੀ ਸਕਰੀਨ 'ਤੇ ਦੇਖ ਦੇਖ ਕੇ ਸਿਰ ਵੀ ਦਰਦ ਕਰਨ ਲੱਗ ਜਾਂਦਾ ਸੀ ਵਧੀਆ ਨਹੀਂ ਸੀ ਬਸ ਕਰਨਾ ਪੈਣਾ ਸੀ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਲੋਸ ਨਾ ਹੋ ਜੇ ਇਸ ਕਰਕੇ ਸਾਨੂੰ ਸਿਲੇਬਸ ਵੀ ਪੂਰਾ ਕਰਵਾਉਣਾ ਸੀ ਬੱਚੇ ਕਿਸੇ ਹੱਦ ਤੱਕ ਕਰਦੇ ਵੀ ਸੀ ਪਰ ਕਰਦੇ ਉਹੀ ਬੱਚੇ ਸੀ ਜਿਹੜੇ ਕਰਨ ਵਾਲੇ ਸੀ ਜਿਹਨਾਂ ਦਾ ਦਿਲ ਨਹੀਂ ਕਰਦਾ ਸੀ ਉਹ ਨਹੀਂ ਕਰਦੇ ਸਨ